ਮੈਂ ਇੱਕ ਹਫਤੇ ਪਹਿਲਾਂ ਇੱਕ ਕੈਮਰਾ ਲਿਆ ਸੀ ਸੰਧੂ ਇਲੈਕਟਰੋਨਿਕਸ ਤੋਂ ਕਿਉਂਕਿ ਮੈਂ ਕਿਸੇ ਅਡਵੈਂਚਰ 'ਤੇ ਜਾਣਾ ਸੀ ਤਾਂ ਉਥੋਂ ਦੀਆਂ ਮੈਂ ਸਾਰੀ ਯਾਦਾਂ ਆਪਣੇ ਕੋਲ ਸਾਂਭ ਕੇ ਰੱਖਣਾ ਚਾਹੁੰਦੀ ਸੀ ਸੋ ਇਸ ਕਰਕੇ ਮੈਂ ਕੈਮਰਾ ਲਿਆ ਉਹਨਾਂ ਦਿਨਾਂ ਵਿੱਚ ਉਹ ਜਿਹੜੀ ਇਲੈਕਟਰੋਨਿਕ ਸ਼ੋਪ ਤੋਂ ਮੈਂ ਲਿਆ ਸੀ ਕੈਮਰਾ ਉਥੇ ਇਕ ਸਪੈਸ਼ਲ ਡਿਸਕਾਊਂਟ ਚੱਲ ਰਿਹਾ ਸੀ ਸਪੈਸ਼ਲ ਆਫਰ ਚੱਲ ਰਿਹਾ ਸੀ ਸੋ ਮੈਨੂੰ ਵਧੀਆ ਡਿਸਕਾਊਂਟ ਵੀ ਮਿਲ ਗਿਆ ਇਹ ਕੈਮਰਾ ਬਹੁਤ ਵਧੀਆ ਹੈ ਇਹਦੀ ਸਟੋਰੇਜ ਵੀ ਬਹੁਤ ਵਧੀਆ ਹੈ ਇਹਦੇ ਵਿਚ ਐਚ ਡੀ ਫੋਟੋ ਆਉਂਦੀ ਹੈ ਪੂਰੀ ਇਹ ਕੈਮਰਾ ਇਸਦੀ ਸਟੋਰੇਜ ਵੀ ਕਾਫੀ ਵਧੀਆ ਹੈ ਅਫੋਰਡੇਬਲ ਵੀ ਬਹੁਤ ਇੱਕ ਵਾਰੀ ਮੈਂ ਫੋਟੋ ਕਲਿੱਕ ਕਰ ਰਹੀ ਸੀ ਤਾਂ ਇੱਕ ਮੈਥੋਂ ਗਲਤੀ ਨਾਲ ਡਿੱਗ ਗਿਆ ਪਰ ਇਹ ਟੁੱਟਿਆ ਨਹੀਂ ਇਹਦੀ ਬਹੁਤ ਵਧੀਆ ਕੁਆਲਿਟੀ ਹੈ ਮਤਲਬ ਬਹੁਤ ਵਧੀਆ ਕੈਮਰਾ ਹੈ ਇਹ ਡਿੱਗ ਜਾਣ ਦੇ ਕਾਰਨ ਫਿਰ ਵੀ ਇਹਨੂੰ ਕੁਛ ਜਿਆਦਾ ਨਹੀਂ ਹੋਇਆ ਇਹ ਵਧੀਆ ਚੱਲ ਰਿਹਾ ਸੀ ਇਹਦੀ ਕੁਆਲਿਟੀ ਬਹੁਤ ਵਧੀਆ ਹੈ ਫੋਟੋਜ ਵੀ ਬਹੁਤ ਵਧੀਆ ਹਨ ਮੈਂ ਲੋਕਾਂ ਨੂੰ ਵੀ ਕਿਹਾ ਬਹੁਤ ਵਧੀਆ ਮੇਰੇ ਫਰੈਂਡਸ ਮੇਰੇ ਤੋਂ ਪੁੱਛ ਰਹੇ ਸੀ ਵੀ ਇਹ ਕੈਮਰਾ ਕਿੱਥੋਂ ਲਿਤਾ ਹੈ ਬਹੁਤ ਵਧੀਆ ਕੈਮਰਾ ਵੀ ਉਹ ਪੁੱਛ ਰਹੇ ਸੀ ਵੀ ਇਹਦੇ 'ਚ ਫੁੱਲ ਪੂਰੀ ਐਚ ਡੀ ਫੋਟੋ ਆਉਂਦੀ ਹੈ ਬਹੁਤ ਵਧੀਆ ਕੈਮਰਾ ਡਿੱਗ ਜਾਣ ਦੇ ਕਾਰਨ ਵੀ ਤੈਥੋਂ ਇਹ ਇਨਾ ਕੋਈ ਇਹਨੂੰ ਨੁਕਸਾਨ ਨਹੀਂ ਹੋਇਆ ਬਹੁਤ ਵਧੀਆ ਐਨ ਇਹ ਕੈਮਰਾ